ਵੈਸੇ ਤਾਂ ਕੋਈ ਵੀ ਬੰਦਾ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ ਉਸਨੂੰ ਵੈਸੇ ਕੋਈ ਵੱਡੀ ਪੂੰਜੀ ਦੀ ਲੋੜ ਨਹੀਂ ਹੁੰਦੀ ਪਰ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਕਿਤੇ ਤੁਹਾਨੂੰ ਆਪਣਾ ਵੱਡਾ ਕਾਰੋਬਾਰ ਸ਼ੁਰੂ ਕਰਨਾ ਹੋਵੇ ਤੁਹਾਨੂੰ ਬਹੁਤ ਵੱਡੀ ਪੂੰਜੀ ਦੀ ਲੋੜ ਪੈ ਜਾਂਦੀ ਹੈ ਕਾਫੀ ਜਾਣੇ ਲੋਕ ਗੱਲਾਂ ਨੂੰ ਸਮਝਦੇ ਨੇ ਪਰ ਕਈ ਵਾਰੀ ਉਹਨਾਂ ਲਈ ਇਹ ਮੁਸ਼ਕਿਲ ਕਾਰਨ ਹੋ ਸਕਦਾ ਹੈ ਜਾਂ ਇਹ ਜਾਣਨਾ ਜ਼ਰੂਰੀ ਹੈ ਕਿ ਬਈ ਕਿ ਇੱਕ ਵੱਡਾ ਕਾਰੋਬਾਰ ਸ਼ੁਰੂ ਕਰਨ ਲਈ ਇੱਕ ਵੱਡੀ ਪੂੰਜੀ ਦੀ ਬਹੁਤ ਜ਼ਿਆਦਾ ਜ਼ਰੂਰੀ ਆ ਕਾਰੋਬਾਰ ਵੈਸੇ ਤਾਂ ਛੋਟੇ ਤੋਂ ਛੋਟਾ ਵੀ ਜਾਂ ਵੱਡੇ ਤੋਂ ਵੱਡਾ ਹੋਵੇ ਹਰੇਕ ਕਾਰੋਬਾਰ ਬਹੁਤ ਵਧੀਆ ਹੁੰਦਾ ਹੈ ਜ਼ਰੂਰੀ ਨਹੀਂ ਹੈ ਕਿ ਤੁਸੀਂ ਵੱਡਾ ਕਾਰੋਬਾਰ ਹੀ ਸ਼ੁਰੂ ਕਰਨਾ ਹੈ ਤੁਸੀਂ ਛੋਟੇ ਤੋਂ ਵੀ ਸਟਾਰਟ ਕਰ ਸਕਦੇ ਹੋ ਲੇਕਿਨ ਤੁਹਾਨੂੰ ਜੇ ਵੱਡਾ ਹੀ ਕਾਰੋਬਾਰ ਸ਼ੁਰੂ ਕਰਨਾ ਹੈ ਤਾਂ ਤੁਸੀਂ ਇਹੋ ਜਿਹੀ ਜਗ੍ਹਾ 'ਤੇ ਸਟਾਰਟ ਕਰੋ ਜਿੱਥੇ ਲੋਕਾਂ ਦੀ ਬਹੁਤ ਜ਼ਿਆਦਾ ਗਿਣਤੀ ਹੋਵੇ ਯਾਨੀ ਕਿ ਜਨਸੰਖਿਆ ਬਹੁਤ ਜ਼ਿਆਦਾ ਹੋਵੇ ਜਿੱਥੇ ਲੋਕਾਂ ਦੇ ਘਰ ਬਹੁਤ ਜ਼ਿਆਦਾ ਹੋਣ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਇੱਥੇ ਵੀ ਇਹ ਇਹ ਕਾਰੋਬਾਰ ਚਲਦਾ ਪਿਆ ਹੈ ਜੇ ਉਹਨਾਂ ਨੂੰ ਪਤਾ ਲੱਗੇਗਾ ਤਾਂ ਉਹ ਜਲਦੀ ਤੋਂ ਜਲਦੀ ਤੁਹਾਡੇ ਕੋਲੋਂ ਆ ਕੇ ਸਮਾਨ ਖਰੀਦਣਗੇ ਪਰ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਕਾਰੋਬਾਰ ਵੱਡਾ ਹੀ ਡਾਇਰੈਕਟ ਸ਼ੁਰੂ ਕਰਨਾ ਪਵੇ ਜਾਂ ਤੁਹਾਨੂੰ ਇਹੋ ਜਿਹੀ ਜਗ੍ਹਾ 'ਤੇ ਜ਼ਮੀਨ ਹੀ ਆਪਣੇ ਕਮਰਾ ਬਣਾਉਣਾ ਪਵੇ ਜਿੱਥੇ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਹੈ ਗੱਲ ਇਹ ਹੈ ਕਿ ਕਾਰੋਬਾਰ ਸ਼ੁਰੂ ਕਰਨ ਲਈ ਬਸ ਤੁਹਾਡੇ ਕੋਲ ਇੱਕ ਚੰਗੀ ਮੈਨੇਜਮੈਂਟ ਸਕਿਲ ਹੋਣੀ ਚਾਹੀਦੀ ਹੈ ਮੈਨੇਜਮੈਂਟ ਸਕਿਲ ਦਾ ਮਤਲਬ ਹੈ ਕਿ ਤੁਹਾਨੂੰ ਇੱਕ ਚੰਗੀ ਤਰ੍ਹਾਂ ਤੁਹਾਨੂੰ ਆਪਣੇ ਕਾਰੋਬਾਰ ਨੂੰ ਵੇਖਣਾ ਆਉਣਾ ਚਾਹੀਦਾ ਹੈ ਬਾਕੀ ਪੂੰਜੀ ਦੀ ਤਾਂ ਲੋੜ ਤਾਂ ਹੁੰਦੀ ਹੈ ਪੂੰਜੀ ਭਾਵੇਂ ਜ਼ਿਆਦਾ ਹੋਵੇ ਜਾਂ ਥੋੜ੍ਹੀ ਹੋਵੇ ਜੇ ਜ਼ਿਆਦਾ ਵੱਡਾ ਕਾਰੋਬਾਰ ਸ਼ੁਰੂ ਕਰਨਾ ਹੈ ਅਤੇ ਜ਼ਿਆਦਾ ਪੂੰਜੀ ਮਿਲੇ ਲੱਗੇਗੀ ਜੇ ਵੱਡਾ ਕ ਕਾਰੋਬਾਰ ਸ਼ੁਰੂ ਕਰਨਾ ਤਾਂ ਪੂੰਜੀ ਤਾਂ ਜ਼ਿਆਦਾ ਲੱਗਣੀ ਲੱਗਣੀ ਹੈ ਲੇਕਿਨ ਜੋ ਛੋਟੇ ਕਾਰੋਬਾਰ 'ਤੇ ਵੀ ਸ਼ੁਰੂ ਕਰੋਗੇ ਤਾਂ ਵੀ ਉਹ ਇੱਕ ਨਾ ਇੱਕ ਦਿਨ ਤੁਹਾਨੂੰ ਫਲ ਤਾਂ ਦੇਵੇਗਾ ਹੀ ਦੇਵੇਗਾ ਇਸ ਲਈ ਤੁਸੀਂ ਕੰਮ ਕਰ ਸਕਦੇ ਹੋ ਤੁਸੀਂ ਛੋਟੇ ਤੋਂ ਸਟਾਰਟ ਕਰ ਸਕਦੇ ਹੋ ਨਾ ਕਿ ਸਿੱਧਾ ਹੀ ਵੱਡੇ ਤੋਂ ਤੁਸੀਂ ਸਟਾਰਟ ਕਰੋ ਸ਼ੁਰੂ ਕਰਨਾ ਅਤੇ ਛੋਟੇ ਤੋਂ ਵੀ ਕਰ ਲਓ ਧੰਨਵਾਦ